ਹੈਲੋ ਕਿਆ ਹਾਲ ਆ ਬਾਈ ਜੀ ਸਵਿਗੀ ਤੋਂ ਬੋਲ ਰਹੇ ਹੋ ਮੈਨੇ ਸਵਿਗੀ ਤੋਂ ਫੂਡ ਔਡਰ ਕਰਿਆ ਸੀਗਾ ਜੀ ਟਾਈਮਿੰਗ ਦਸ ਵਜੇ ਦੀ ਸੀਗੀ ਉਹ ਮੇਰੇ ਕੋਲ ਹਜੇ ਤੱਕ ਪਹੁੰਚਿਆ ਨਹੀਂ ਕਿਰਪਾਲਤਾ ਮੈਨੂੰ ਦੱਸੋਗੇ ਕੀ ਅੜਚਨ ਆ ਰਹੀ ਆ ਬਾਕੀ ਤੁਹਾਡਾ ਖਾਣਾ ਬੜਾ ਸਵਾਦ ਹੁੰਦਾ ਕਿਰਪਾ ਮੇਰੇ ਘਰ ਗੈਸਟ ਆਏ ਨੇ ਮਾੜਾ ਜਿਹਾ ਜਲਦੀ ਕੀਤਾ ਜਾਵੇ ਅਸੀਂ ਤੁਹਾਡੇ ਤੋਂ ਹੀ ਫੂਡਰ ਔਡਰ ਕਰਦੇ ਹਾਂ ਹੋਰ ਅੱਗੇ ਵੀ ਅਸੀਂ ਤੁਹਾਡੇ ਤੋਂ ਹੀ ਔਡਰ ਕਰਦੇ ਰਵਾਂਗੇ ਧੰਨਵਾਦ ਨਾਂ ਮੇਰਾ ਕੇਸ਼ਵ ਆ